ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਬਿੰਦਰ ਸਿੰਘ ਬੋਲ ਰਿਹਾ ਸੀਗਾ ਜੀ ਬਾਈ ਇੱਕ ਓਲਾ ਕੈਬ ਬੁੱਕ ਕਰਨਾ ਸੀ ਹਾਂਜੀ ਅਸੀਂ ਅੰਮ੍ਰਿਤਸਰ ਸਾਹਿਬ ਜਾਣਾ ਸੀਗਾ ਹਾਂ ਕੱਲ੍ਹ ਨੂੰ ਜਾਣਾ ਸੀਗਾ ਜੀ ਹਾਂਜੀ ਇੱਕ ਸਾਨੂੰ ਡਰਾਈਵਰ ਬਾਰੇ ਜਾਣਕਾਰੀ ਦਿਓ ਵੀ ਜਿਹੜਾ ਡਰਾਈਵਰ ਆ ਰਿਹਾ ਇੱਕ ਤਾਂ ਉਹ ਵੀ ਮਤਲਬ ਸਹੀ ਟਾਈਮ 'ਤੇ ਪਹੁੰਚ ਜੇ ਇੱਕ ਜਿਹੜਾ ਡਰਾਈਵਰ ਆ ਤੁਹਾਡਾ ਉਹ ਸਾਰੇ ਜਿੰਨੇ ਵੀ ਇੱਥੇ ਘੁੰਮਣ ਵਾਲੇ ਸਥਾਨ ਨੇ ਜਿਵੇਂ ਅੰਮ੍ਰਿਤਸਰ ਹੋ ਗਿਆ ਹੈ ਨਾ ਵਾਹਗਾ ਬਾਰਡਰ ਹੋ ਗਿਆ ਉਹ ਜੋ ਜਿੰਨੀਆਂ ਵੀ ਉੱਥੇ ਘੁੰਮਣ ਵਾਲੀਆਂ ਥਾਵਾਂ ਨੇ ਉਹਨਾਂ ਦਾ ਚੰਗੀ ਤਰ੍ਹਾਂ ਜਾਣੂ ਹੋਵੇ ਬਾਕੀ ਵੱਡੀ ਗੱਲ ਹੈ ਵੀ ਉਹ ਸ਼ਰਾਬ ਵਗੈਰਾ ਤੋਂ ਨਾ ਪੀਂਦਾ ਹੋਵੇ ਵਧੀਆ ਬੰਦਾ ਹੋਵੇ ਜਿਹੜਾ ਇੱਕ ਡਰਾਈਵਰਿੰਗ ਦੇ ਵਿੱਚ ਵੀ ਵਧੀਆ ਹੋਵੇ ਇਸ ਤਰ੍ਹਾਂ ਨਾ ਹੋਵੇ ਕਿ ਰਸਤੇ ਦੇ ਵਿੱਚ ਹੀ ਗੱਡੀ ਨਾ ਚਲਾਉਣੀ ਆਉਂਦੀ ਹੋਵੇ ਵਧੀਆ ਜਾਂ ਐਕਸੀਡੈਂਟ ਕਰਾ ਦੇ ਕੋਈ ਵਧੀਆ ਸਿਆਣਾ ਬੰਦਾ ਹੋਵੇ ਜੀ ਹਾਂਜੀ ਪੜ੍ਹਿਆ ਲਿਖਿਆ ਵੀ ਹੋਵੇ ਥੋੜ੍ਹਾ ਬਹੁਤਾ ਹਾਂਜੀ ਹਾਂ ਕਿਉਂਕਿ ਨਾਲ ਬੱਚੇ ਹੋਣਗੇ ਪਰਿਵਾਰ ਹੋਊਗਾ ਪੂਰਾ ਜੇਕਰ ਡਰਾਈਵਰ ਕੰਡੈਕਟਰ ਅੱਜ ਕੱਲ੍ਹ ਠੀਕ ਨਹੀਂ ਆ ਰਹੇ ਬਹੁਤ ਵਿੱਚ ਵਿੱਚ ਮਾਹੌਲ ਖਰਾਬ ਹੈ ਨਸ਼ੇੜੀ ਮਿਲ ਜਾਂਦੇ ਨੇ ਕਈ ਵਾਰ ਜਾਂ ਸ਼ਰਾਬ ਪੀ ਕੇ ਗੱਡੀ ਕਿਸੇ ਦੇ ਐਕਸੀਡੈਂਟ ਕਰ ਦਿੰਦੇ ਨੇ ਉਸ ਤਰ੍ਹਾਂ ਦਾ ਨਾ ਹੋਵੇ ਹਾਂਜੀ ਬਾਈ ਜੀ ਅਸੀਂ ਕੱਲ੍ਹ ਨੂੰ ਇੱਕ ਡਰਾਈਵਰ ਵੀ ਚੱਲ ਟਾਈਮ 'ਤੇ ਪਹੁੰਚ ਜੇ ਅਸੀਂ ਕੱਲ੍ਹ ਨੂੰ ਜਾਣਾ ਚਾਹੁੰਦੇ ਸੀਗੇ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਠੀਕ ਆ ਬਾਈ ਸ਼ੁਕਰੀਆ